ਹਾਂਜੀ ਮੈਨੂੰ ਸ਼ੁਰੂ ਤੋਂ ਅਦਾਕਾਰੀ ਦੇ ਵਿੱਚ ਸ਼ੌਂਕ ਸੀ ਮੈਂ ਹਮੇਸ਼ਾ ਸਕੂਲ ਸਮੇਂ ਤੋਂ ਹੀ ਸਕੂਲ ਵਿੱਚ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ਚ ਭਾਗ ਲੈਂਦੀ ਸੀ ਇਹ ਸਮੇਂ ਮੇਰਾ ਕਾਲਜ ਟਾਈਮ ਵਿੱਚ ਵੀ ਰਿਹਾ ਮੈਂ ਇੱਕ ਵਾਰ ਕਾਫੀ ਵੱਡੇ ਪਹਿਰ ਤੇ ਯੁਵਕ ਮੇਲਾ ਦੇ ਹੋਣ ਵਾਲੇ ਨਾਟਕਾਂ ਦੇ ਵਿੱਚ ਆਪਣੀ ਅਦਾਕਾਰੀ ਦੀ ਧਾਕ ਜਮਾਈ ਮੇਰੇ ਨਾਟਕ ਦਾ ਵਿਸ਼ਾ ਔਰਤ ਦੀ ਜ਼ਿੰਦਗੀ ਉੱਪਰ ਸੀ ਇਸ ਦੇ ਹਾਲਤ ਨੂੰ ਬਿਆਨ ਕਰਨਾ ਸੀ ਇਹ ਨਾਟਕ ਸੋਹਣ ਸਿੰਘ ਸੀਤਲ ਦੇ ਮੁੱਲ ਦਾ ਮਾਸ ਤੇ ਅਧਾਰਿਤ ਸੀ ਇਸ ਵਿੱਚ ਪ੍ਰਮੁੱਖ ਅਦਾਕਾਰੀ ਮੇਰੇ ਵੱਲੋਂ ਸੀ ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਅੰਤ ਵਿੱਚ ਸਾਰੇ ਦਰਸ਼ਕਾਂ ਨੇ ਖੜੇ ਹੋ ਕੇ ਮੇਰਾ ਸਵਾਗਤ ਕੀਤਾ ਮੈਨੂੰ ਆਪਣੀ ਅਦਾਕਾਰੀ ਲਈ ਪਹਿਲਾਂ ਇਨਾਮ ਮਿਲਿਆ ਸਟੇਜ ਦੇ ਮੇਰੀ ਬਹੁਤ ਤਰੀਫ ਤਾਰੀਫ ਕੀਤੀ ਗਈ ਤੇ ਮੈਨੂੰ ਉਸ ਸਾਲ ਦਾ ਸਭ ਤੋਂ ਵਧੀਆ ਕਲਾਕਾਰ ਦਾ ਅਵਾਰਡ ਮਿਲਿਆ ਜਿਹੜਾ ਕਿ ਮੇਰੇ ਲਈ ਬੜਾ ਹੀ ਅਨਮੋਲ ਸੀ